ਮੇਰੀ ਸਭ ਤੋਂ ਵੱਡੀ ਚੁਣੌਤੀ ਸੀ ਜਦੋਂ ਮੇਰਾ ਰਿਸ਼ਤਾ ਹੋਇਆ ਮੈਂ ਵਿਆਹ ਕੇ ਦੂਸਰੇ ਘਰ ਚਲੀ ਗਈ ਮੈਨੂੰ ਉੱਥੇ ਇਹ ਨਹੀਂ ਸੀ ਪਤਾ ਕਿਸੇ ਦਾ ਕੀ ਰਹਿਣਾ ਸਹਿਣਾ ਕਿਸੇ ਦਾ ਕੀ ਹਿਸਾਬ ਕਿਤਾਬ ਸੀ ਕਿੱਦਾਂ ਕਿੱਦਾਂ ਪਰਿਵਾਰ ਦੇ ਲੋਕ ਰਹਿੰਦੇ ਸੀ ਕੀ ਖਾਂਦੇ ਸੀ ਕੀ ਪਾਉਂਦੇ ਸੀ ਕਿੱਥੇ ਜਾਂਦੇ ਸੀ ਕਿਸ ਤਰ੍ਹਾਂ ਬੋਲਦੇ ਸੀ ਕੀ ਕਰਦੇ ਸੀ ਇਸ ਕਰਕੇ ਮੈਂ ਹੌਲੀ ਹੌਲੀ ਟਾਈਮ ਲੱਗਾ ਮੈਨੂੰ ਇਹ ਮੈਂ ਹੌਲੀ ਹੌਲੀ ਉਹਨਾਂ ਦਾ ਖਾਣ ਪੀਣ ਦਾ ਤਰੀਕਾ ਸਿੱਖਿਆ ਰਹਿਣ ਸਹਿਣ ਦਾ ਫਿਰ ਉਹਨਾਂ ਦੇ ਪਹਿਰਾਵੇ ਦਾ ਫਿਰ ਆਉਣ ਜਾਣ ਦਾ ਹੌਲੀ ਹੌਲੀ ਮੈਂ ਸਾਰੇ ਤਰੀਕੇ ਸਿੱਖੇ ਇਹ ਚੁਣੌਤੀ ਮੈਂ ਪਾਰ ਕੀਤੀ ਫਿਰ ਅੱਗੇ ਮੈਨੂੰ ਇਹਨਾਂ ਦਾ ਇਹ ਨਹੀਂ ਸੀ ਪਤਾ ਹੁੰਦਾ ਕਿ ਮੈਂ ਇਹਨਾਂ ਦੇ ਨਾਲ ਕਿਸ ਤਰ੍ਹਾਂ ਰਹਾਂ ਕਿਸ ਤਰ੍ਹਾਂ ਬੋਲਾਂ ਕੀ ਗੱਲ ਕਰਾਂ ਕੀ ਨਾ ਕਰਾਂ ਫਿਰ ਮੈਨੂੰ ਹੌਲੀ ਹੌਲੀ ਇਸ ਚੀਜ਼ ਦਾ ਪਤਾ ਲੱਗਾ ਫਿਰ ਮੈਂ ਜਿਸ ਤਰ੍ਹਾਂ ਇਹਨਾਂ ਨੇ ਦੇਖਿਆ ਇਹਨਾਂ ਨੂੰ ਮੈਂ ਉਸ ਤਰ੍ਹਾਂ ਮੈਂ ਕਰਦੀ ਰਹੀ ਫਿਰ ਮੈਂ ਬੱਚਿਆਂ ਦੇ ਬਾਰੇ ਬੱਚਿਆਂ ਦੀਆਂ ਪੜ੍ਹਾਈਆਂ ਬੱਚਿਆਂ ਨੂੰ ਪੜ੍ਹਾਉਣਾ ਆਉਣਾ ਜਾਣਾ ਬੱਚਿਆਂ ਨੂੰ ਸਾਂਭਣ ਦਾ ਤਰੀਕਾ ਇਹ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਇਸਦਾ ਦਾ ਸਾਥ ਮੇਰੇ ਸਾਰੇ ਪਰਿਵਾਰ ਨੇ ਸਹੁਰੇ ਪਰਿਵਾਰ ਨੇ ਅਤੇ ਮੇਰੇ ਘਰਵਾਲੇ ਨੇ ਜੀਵਨ ਸਾਥੀ ਨੇ ਮੇਰਾ ਸਾਥ ਦਿੱਤਾ ਮੇਰੇ ਬੱਚਿਆਂ ਨੇ ਵੀ ਮੇਰਾ ਸਾਥ ਦਿੱਤਾ